ਪਿਛਲੇ ਕਈਆਂ ਸਾਲਾਂ ਵਿੱਚ ਆਹ ਦੇਖਿਆ ਗਿਆ ਹੈ ਕਿ ਮੌਸਮ ਵਿੱਚ ਬੜੀ ਤਬਦੀਲੀਆਂ ਆ ਗਈਆਂ ਨੇ ਅਤੇ ਕਿਸਾਨ ਨੂੰ ਮੌਸਮ ਦੀ ਮਾਰ ਸਭ ਤੋਂ ਵੱਡੀ ਮਾਰ ਹੈ ਜੇਕਰ ਬੇ ਮੌਸਮ ਬਾਰਿਸ਼ ਆ ਜਾਏ ਜਾਂ ਹੜ੍ਹ ਆ ਜਾਏ ਅਤੇ ਇਹਦੇ ਨਾਲ ਉਹਦੀ ਫਸਲ ਦਾ ਬੜਾ ਨੁਕਸਾਨ ਹੁੰਦਾ ਹੈ ਇਸ ਤੋਂ ਬੱਚਣ ਲਈ ਕਿਸਾਨ ਕਈ ਵਾਰੀ ਆਪਣੀ ਫਸਲ ਦਾ ਇਨਸੋ਼ਰੈਂਸ ਕਰਾ ਲੈਂਦਾ ਹੈ ਸਰਕਾਰ ਵੀ ਆਪਣੇ ਪੱਧਰ 'ਤੇ ਕਈ ਵਾਰੀ ਕੰਪਨਸ਼ੇਸ਼ਨ ਦਿੰਦੀ ਹੈ ਜੇਕਰ ਕੋਈ ਇੱਦਾਂ ਦੀ ਤ੍ਰਾਸਦੀ ਆਉਂਦੀ ਆ ਪਰ ਇਹ ਕੰਪਨਸ਼ੇਸ਼ਨ ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਕਰ ਪਾਉਂਦਾ ਅਤੇ ਉਹਨੂੰ ਬੜਾ ਨੁਕਸਾਨ ਝੱਲਣਾ ਪੈਂਦਾ ਹੈ